ਮੈਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਸ਼ੌਂਕ ਹੈ ਯਾਤਰਾ ਕਰਨ ਦਾ ਮੈਨੂੰ ਹਰ ਸਮੇਂ ਇਹੀ ਰਹਿੰਦਾ ਹੈ ਕਿ ਮੈਂ ਵੱਧ ਤੋਂ ਵੱਧ ਘੁੰਮਾਂ ਆਲ਼ੇ ਦੁਆਲ਼ੇ ਦੇ ਕਲਚਰ ਦੇਖਾਂ ਸੱਭਿਆਚਾਰਕ ਦੇਖਾਂ ਹੋਰ ਦੇਸ਼ ਦੇਖਾਂ ਮੈਨੂੰ ਸਭ ਤੋਂ ਵੱਧ ਚਾਅ ਉਦੋਂ ਹੁੰਦਾ ਜਦੋਂ ਮੈਂ ਕਿਤੇ ਬਾਹਰ ਘੁੰਮਣ ਜਾਂਦਾ ਹਾਂ ਮੈਨੂੰ ਬਹੁਤ ਸ਼ੌਂਕ ਹੈ ਘੁੰਮਣ ਦਾ ਜਿਵੇਂ ਕਿ ਮੈਂ ਦੱਸਦਾ ਐਂ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਮੈਂ ਦੁਬਈ ਦੀ ਯਾਤਰਾ ਕੀਤੀ ਮੇਰਾ ਭਰਾ ਉੱਥੇ ਰਹਿੰਦਾ ਏ ਅਤੇ ਮੈਂ ਕਾਫੀ ਟਾਈਮ ਤੋਂ ਕਹਿ ਰਿਹਾ ਸੀ ਮੈਂ ਵੀ ਦੁਬਈ ਜਾਣਾ ਚਾਹੁੰਦਾ ਦੇਖਣਾ ਚਾਹੁੰਦਾ ਸੁਣਨ ਵਿੱਚ ਆਇਆ ਸੀ ਕਿ ਦੁਬਈ ਇੱਕ ਇਹੋ ਜਿਹੀ ਜਗ੍ਹਾ ਹੈ ਜੋ ਪੂਰੀ ਵਰਲਡ ਵਿੱਚ ਖੂਬਸੂਰਤ ਹੈ ਹੋਰ ਦੇਸ਼ਾਂ ਦੇ ਲੋਕ ਵੀ ਉਥੇ ਘੁੰਮਣ ਆਉਂਦੇ ਹਨ ਇੰਨੀ ਪ੍ਰਸਿੱਧ ਹੈ ਜਿਵੇਂ ਕਿ ਉਥੇ ਬੁਰਜ ਖਲੀਫਾ ਹੈ ਡਿਸਕਵਰੀ ਗਾਰਡਨ ਹੈ ਕਾਫੀ ਇਹੋ ਜਿਹੇ ਇਲਾਕੇ ਹਨ ਜਿੱਥੇ ਕਿ ਦੇਖਣ ਦੇ ਲਾਇਕ ਹੈ ਆਈਸਲੈਂਡ ਹੈ ਆਈਸਲੈਂਡ ਇਸ ਤਰਾਂ ਬਣਾਇਆ ਹੋਇਆ ਇਕ ਸ਼ਹਿਰ ਬਣਾਇਆ ਹੋਇਆ ਜਿਸ ਦੇ ਅੰਦਰ ਕਿ ਸਾਰਾ ਆਈਸ ਦਾ ਹੀ ਹੈ ਇੰਝ ਫੀਲ ਹੁੰਦਾ ਜਿਵੇਂ ਤੁਸੀਂ ਕਿ ਕਿਸੇ ਆਈਸਲੈਂਡ ਵਿੱਚ ਹੀ ਬੈਠੇ ਹੋ ਵੈਸੇ ਬਾਹਰ ਟੈਂਪਰੇਚਰ ਹੋਰ ਹੈ ਅੰਦਰ ਇਹੋ ਜਿਹੇ ਹਿਸਾਬ ਨਾਲ ਟੈਂਪਰੇਚਰ ਮੈਨਟੇਨ ਕੀਤਾ ਕਿ ਦੇਖਣ ਵਿੱਚ ਲੱਗ ਰਿਹਾ ਅਸੀਂ ਆਈਸਲੈਂਡ ਵਿੱਚ ਬੈਠੇ ਐਂ ਹੋਰ ਬਹੁਤ ਖੂਬੀਆਂ ਨੇ ਇਸੇ ਤਰੀਕੇ ਕਰਕੇ ਕਿ ਮੈਂ ਦੇਖਣਾ ਚਾਹੁੰਦਾ ਸੀ ਅਤੇ ਕਿਵੇਂ ਐਂ ਦੁਬਈ ਕਿਸ ਤਰ੍ਹਾਂ ਦੀ ਹੈ ਦੇਖਣ ਵਿੱਚ ਅਤੇ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਉਹਨੇ ਮੈਨੂੰ ਵੀਜ਼ਾ ਭੇਜਿਆ ਮੈਂ ਗਿਆ ਉੱਥੇ ਜਾਂਦੇ ਹੀ ਮੈਨੂੰ ਮੇਰਾ ਭਰਾ ਲੈ ਗਿਆ ਏਅਰਪੋਰਟ ਤੋਂ ਏਅਰਪੋਰਟ ਤੋਂ ਰੂਮ ਤੱਕ ਗਏ ਅਸੀਂ ਉੱਥੇ ਮੈਂ ਇੱਕ ਰਾਤ ਉੱਥੇ ਰੈਸਟ ਕੀਤੀ ਪੂਰੀ ਆਰਾਮ ਕੀਤਾ ਸੋ ਅਤੇ ਫਿਰ ਅਗਲੇ ਦਿਨ ਅਸੀਂ ਘੁੰਮਣ ਚੱਲ ਗਏ ਮੇਰਾ ਮੇਨ ਉਦੇਸ਼ ਇਹੀ ਸੀ ਕਿ ਮੈਂ ਦੁਬਈ ਨੂੰ ਦੇਖਣਾ ਚਾਹੁੰਦਾ ਸੀ ਨਜ਼ਦੀਕ ਤੋਂ ਉਹਦੇ ਹਰ ਇੱਕ ਸ਼ਹਿਰ ਨੂੰ ਦੇਖਣਾ ਚਾਹੁੰਦਾ ਸੀ ਵੈਸੇ ਕਿ ਆਪਾਂ ਕਹਿ ਸਕਦੇ ਹਾਂ ਦੁਬਈ ਤਾਂ ਇੱਕ ਸ਼ਹਿਰ ਹੀ ਹੈ ਮੈਂ ਗਿਆ ਕਹਿ ਸਕਦਾਂ ਦੁਬਈ ਇੱਕ ਸ਼ਹਿਰ ਹੈ ਜੋ ਕਿ ਆਪਾਂ ਕਹਿ ਦਿੰਨੇ ਹਾਂ ਕਿ ਦੁਬਈ ਜਾ ਰਿਹਾ ਯੂ ਏ ਈ ਗਿਆ ਅਤੇ ਉੱਥੇ ਦੇਖਿਆ ਚਲੋ ਘੁੰਮਿਆ ਨਾਲ ਲੱਗਦੇ ਹੋਰ ਏਅਰਪੋਰਟ ਵੀ ਦੇਖੇ ਹੋਰ ਕਾਫੀ ਜਗ੍ਹਾ ਦੇਖੀਆਂ ਸਭ ਤੋਂ ਪਹਿਲਾਂ ਅਸੀਂ ਡਿਸਕਵਰੀ ਗਾਰਡਨ ਗਏ ਡਿਸਕਵਰੀ ਗਾਰਡਨ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਆਈਸਲੈਂਡ ਜੋ ਦੱਸਿਆ ਉੱਥੇ ਘੁੰਮੇ ਪੂਰਾ ਦਿਨ ਹੀ ਇੱਕ ਦਿਨ ਤਾਂ ਉੱਥੇ ਅਸੀਂ ਲਗਾ ਦਿੱਤਾ ਇੰਨਾ ਵਧੀਆ ਲੱਗਿਆ ਅਤੇ ਦਿਲ ਲੱਗਿਆ ਦੇਖਣ ਨੂੰ ਬਹੁਤ ਲੱਗਿਆ ਵਧੀਆ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਤਿਆਰੀ ਕੀਤੀ ਕਿ ਅੱਜ ਬੁਰਜ ਖਲੀਫਾ ਦੇਖਣ ਚੱਲਦੇ ਹਾਂ ਸਵੇਰ ਤੋਂ ਅਸੀਂ ਗਏ ਦਸ ਵਜੇ ਪਹੁੰਚੇ ਬੁਰਜ ਖਲੀਫਾ ਅਸੀਂ ਬਾਹਰ ਤੋਂ ਦੇਖਣ ਵਿੱਚ ਉੱਪਰ ਨੂੰ ਦੇਖਦੇ ਇੰਝ ਫੀਲ ਹੋ ਰਿਹਾ ਕਿ ਇੰਨੀ ਉਚਾਈ ਤੱਕ ਬਣਾਏ ਹੋਏ ਆ ਕਿਵੇਂ ਫੀਲ ਹੋ ਰਿਹਾ ਵੀ ਆਪਾਂ ਉੱਪਰ ਜਾਵਾਂਗੇ ਕਿਵੇਂ ਅਸੀਂ ਲਾਸਟ ਫਲੋਰ ਤੱਕ ਜਾ ਕੇ ਆਏ ਘੁੰਮਿਆ ਵਧੀਆ ਲੱਗਿਆ ਬਹੁਤ ਹੀ ਵਧੀਆ ਫੋਟੋਆਂ ਆਈਆਂ ਉੱਥੇ ਦੇਖਣ ਨੂੰ ਚਾਰੇ ਪਾਸਿਓਂ ਵਧੀਆ ਲੱਗ ਰਿਹਾ ਸੀ ਉੱਥੇ ਰੋਡ ਇੰਨੇ ਜ਼ਿਆਦਾ ਵਧੀਆ ਲੱਗੇ ਕਿ ਬਸ ਇੰਝ ਲੱਗ ਰਿਹਾ ਸੀ ਕਿ ਜੰਨਤ ਹੈ ਆਪਣੇ ਦੇਸ਼ ਨਾਲ਼ੋਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸ਼ਹਿਰ ਲੱਗਿਆ ਦੁਬਈ ਦੁਬਈ ਵਿੱਚ ਹੋਰ ਉਥੋਂ ਦੇ ਲੋਕ ਇੰਨੇ ਜ਼ਿਆਦਾ ਖੂਬਸੂਰਤ ਲੱਗਦੇ ਦੇਖਣ ਨੂੰ ਕਿ ਕੋਈ ਕਹਿ ਨਹੀਂ ਸਕਦਾ ਕਿ ਇੰਨੇ ਖੂਬਸੂਰਤ ਹੋਣਗੇ ਦੁਬਈ ਵਿੱਚ ਵੀ ਉਥੋਂ ਦੀਆਂ ਜੋ ਲੜਕੀਆਂ ਹੈ ਲੜਕੀਆਂ ਬਹੁਤ ਸੁੰਦਰ ਹਨ ਬੁਰਕਾ ਲੈ ਕੇ ਰੱਖਦੀਆਂ ਹੈ ਉਹਨਾਂ ਦਾ ਪਹਿਰਾਵਾ ਬਹੁਤ ਅਲੱਗ ਹੈ ਉਹਨਾਂ ਦੀ ਬੋਲ ਚਾਲ ਬਹੁਤ ਜ਼ਿਆਦਾ ਅਲੱਗ ਤਰੀਕੇ ਦੀ ਹੈ ਪਰ ਬਹੁਤ ਵਧੀਆ ਲੱਗਦੇ ਹਨ ਜੋ ਆਪਸ ਵਿੱਚ ਉਹ ਗੱਲ ਕਰਦੇ ਹਨ ਕਾਫੀ ਗੱਲਾਂ ਹੋਰ ਵੀ ਉੱਥੇ ਜਾ ਕੇ ਸਿੱਖਣ ਨੂੰ ਮਿਲੀਆਂ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਮੈਂ ਅੱਗੇ ਤੋਂ ਅੱਗੇ ਹੋਰ ਵੀ ਵੈਸੇ ਘੁੰਮਣਾ ਚਾਹੁੰਦਾ ਏ ਹਾਂ ਮੈਂ ਉਸ ਸ਼ਹਿਰ ਵਿੱਚ ਦੁਬਈ ਸ਼ਹਿਰ ਵਿੱਚ ਪੰਦਰ੍ਹਾਂ ਦਿਨ ਰਹਿ ਕੇ ਆਇਆ ਜਦੋਂ ਮੈਂ ਉਥੋਂ ਵਾਪਸ ਆਇਆ ਮੇਰਾ ਘਰ ਆ ਕੇ ਮਨ ਨਹੀਂ ਲੱਗ ਰਿਹਾ ਸੀ ਕਿਉਂਕਿ ਇੰਨਾ ਵਧੀਆ ਸ਼ਹਿਰ ਘੁੰਮ ਕੇ ਆ ਕੇ ਆਪਣੇ ਇਥੇ ਨੋਰਮਲ ਸ਼ਹਿਰ ਵਿੱਚ ਕੁਝ ਖਾਸ ਨਹੀਂ ਲੱਗ ਰਿਹਾ ਸੀ ਮੈਂ ਆਪਣੇ ਸ਼ਬਦਾਂ ਵਿੱਚ ਇਹ ਹੀ ਕਹਿਣਾ ਚਾਹੁੰਦਾ ਕਿ ਦੁਬਈ ਬਹੁਤ ਹੀ ਸੁੰਦਰ ਹੈ ਮੇਰਾ ਉੱਥੇ ਦਾ ਜੋ ਉਦੇਸ਼ ਸੀ ਦੇਖਣ ਦਾ ਘੁੰਮਣ ਦਾ ਉਹ ਪੂਰਾ ਹੋਇਆ ਅਤੇ ਉਥੋਂ ਦੇ ਕਾਫੀ ਚੀਜ਼ਾਂ ਦੇਖਣ ਨੂੰ ਮਿਲੀਆਂ ਉਥੋਂ ਦਾ ਰਿਟੇਲ ਸਿਸਟਮ ਔਲ ਸਿਲ਼ ਸਿਸਟਮ ਪਰਚੇਜ ਕਰਨਾ ਕਿਵੇਂ ਅਲੱਗ ਅਲੱਗ ਚੀਜ਼ਾਂ ਵਧੀਆ ਤੋਂ ਵਧੀਆ ਹੋਰ ਕਾਫੀ ਆਈਟਮਾਂ ਸਮਾਨ ਦੇਖਿਆ ਖਰੀਦਿਆ ਕਿਸ ਤਰ੍ਹਾਂ ਹੈ ਉੱਥੇ ਵਿਹਾਰ ਕਿੱਦਾਂ ਦਾ ਆ ਰਹਿੰਦੇ ਕਿਵੇਂ ਆ ਬਿਲਡਿੰਗਾਂ ਕਿਸ ਤਰ੍ਹਾਂ ਦੀਆਂ ਹਨ ਸਭ ਕੁਝ ਬਹੁਤ ਹੀ ਵਧੀਆ ਹੈ ਅਤੇ ਬਹੁਤ ਵਧੀਆ ਲੱਗਿਆ